ਅੱਜ ਮੇਰੇ ਭਰਾ ਦਾ ਜਨਮ ਦਿਨ ਹੈ ਤਾਂ ਅਸੀਂ ਬਾਹਰ ਪਾਰਟੀ ਕਰਨ ਦੀ ਯੋਜਨਾ ਬਣਾਈ ਪਾਰਟੀ ਦੇ ਨਾਲ ਨਾਲ ਮੈਂ ਇਹ ਵੀ ਸੋਚਿਆ ਕਿ ਕਿਉਂ ਨਾ ਅੱਜ ਦੀ ਰਾਤ ਮੂਵੀ ਵੇਖੀ ਜਾਵੇ ਅਸੀਂ ਪਾਰਟੀ ਅਬੋਹਰ ਜਾ ਕੇ ਕਰ ਰਹੇ ਹਾਂ ਜੋ ਕਿ ਮੇਰੇ ਸ਼ਹਿਰ ਦੇ ਨਾਲ ਦਾ ਸ਼ਹਿਰ ਹੈ ਇਹ ਸਭ ਲਈ ਸਪ੍ਰਾਈਜ਼ ਸੀ ਪਰ ਮੈਂ ਆਪਣੇ ਮਾਂ ਬਾਪ ਨੂੰ ਦੱਸ ਦਿੱਤਾ ਤਾਂ ਜੋ ਉਹਨਾਂ ਨੂੰ ਮੂਵੀ ਵੇਖਣ 'ਚ ਕੋਈ ਆਪੱਤੀ ਨਾ ਹੋਵੇ ਪਹਿਲਾਂ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਸੰਕੋਚ ਕੀਤਾ ਕਿ ਮੂਵੀ ਕੀ ਕਰਨੀ ਹੈ ਵੇਖ ਕੇ ਆਪਾਂ ਰਹਿਣ ਦੇਂਦੇ ਹਾਂ ਪਰ ਮੈਂ ਜਦੋਂ ਉਹਨਾਂ ਨੂੰ ਮੂਵੀ ਦੇ ਫ਼ਾਇਦੇ ਦੱਸੇ ਤਾਂ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਅਤੇ ਕਹਿਣ ਲੱਗੇ ਕਿ ਤੇਰੇ ਭਰਾ ਨੂੰ ਇਹ ਮੂਵੀ ਬਹੁਤ ਪਸੰਦ ਆਵੇਗੀ ਕਿਉਂਕਿ ਇਹ ਮੂਵੀ ਇਹ ਪਹਿਲੀ ਗੱਲ ਤਾਂ ਨਵੀਂ ਲੱਗੀ ਹੈ ਥੀਏਟਰ ਵਿੱਚ ਜੋ ਹੈ ਕੈਰੀ ਓਨ ਜੱਟਾ ਥ੍ਰੀ ਅਤੇ ਨਾਲ ਹੀ ਇਹ ਬਹੁਤ ਹੀ ਹਾਸੇ ਮਜ਼ਾਕ ਵਾਲੀ ਮੂਵੀ ਹੈ ਜਿਸ ਨੂੰ ਆ ਅਸੀਂ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਵੇਖ ਸਕਦੇ ਹਾਂ ਅਤੇ ਨਾਲ ਹੀ ਐਂਟਰਟੇਨਮੈਂਟ ਦਾ ਸੋਰਸ ਵੀ ਹੈ ਬਸ ਇਹ ਗੱਲ ਮੇਰੇ ਭਰਾ ਨੂੰ ਨਹੀਂ ਪਤਾ ਕਿਉਂਕਿ ਇਹ ਉਹਦੇ ਵਾਸਤੇ ਸਪਰਾਈਜ ਸੀ ਮੈਂ ਟਿਕਟ ਦੀ ਟਿਕਟਾਂ ਬੁੱਕ ਪਹਿਲਾਂ ਹੀ ਦੋ ਦਿਨ ਕਰਵਾ ਦਿੱਤੀਆਂ ਸੀ ਤਾਂ ਜੋ ਸਾਨੂੰ ਟਿਕਟ ਲੈਣ 'ਚ ਕੋਈ ਦਿੱਕਤ ਨਾ ਆਵੇ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਨਾ ਖੜਾ ਹੋਣਾ ਪਵੇ ਅਤੇ ਸਾਡਾ ਸੀਟ ਨੰਬਰ ਵੀ ਇੱਕੀ ਬਾਈ ਤੇਈ ਅਤੇ ਚੌਵੀ ਹੈ ਜੋ ਕਿ ਮੈਨੂੰ ਬਹੁਤ ਹੀ ਪਸੰਦ ਆਇਆ ਨਾ ਜੋ ਕਿ ਵਿੱਚ ਵਿਚਾਲੇ ਮਿਲਿਆ ਹੋਇਆ ਹੈ